ਪੰਜਾਬੀ ਦੀਆਂ ਕਈ ਖੇਤਰੀ ਉਪਭਾਸ਼ਾ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਪੁਆਧੀ ਮਾਝੀ ਦੋਆਬਾ ਅਤੇ ਮਾਲਵਾ ਮੈਂ ਪੁਆਧੀ ਭਾਸ਼ਾ ਸਿੱਖੀ ਹੈ ਜਿਹੜੀ ਕਿ ਬਹੁਤ ਸੌਖੀ ਹੈ ਪਰ ਪੱਛਮੀ ਸੱਭਿਆਚਾਰਾਂ ਦੇ ਪ੍ਰਭਾਵ ਕਾਰਨ ਇਹ ਭਾਸ਼ਾ ਲੁਪਤ ਹੁੰਦੀ ਜਾ ਰਹੀ ਹੈ ਜਿਵੇਂ ਕਿ ਅਸੀਂ ਪੱਛਮੀ ਸੱਭਿਆਚਾਰ ਦੁਆਰਾ ਸਾਡਾ ਖਾਣ ਪੀਣ ਬੋਲਣ ਦਾ ਢੰਗ ਅਤੇ ਕੱਪੜੇ ਪਹਿਨਣ ਦਾ ਢੰਗ ਬਦਲ ਰਿਹਾ ਹੈ ਉਸੇ ਤਰ੍ਹਾਂ ਹੀ ਪੱਛਮੀ ਸੱਭਿਆਚਾਰ ਦੇ ਦੁਆਰਾ ਇਹ ਸਾਡੀ ਭਾਸ਼ਾ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਮਲਵਈ ਭਾਸ਼ਾ ਜਿਹੜੀ ਕਿ ਸ ਖਾਸ ਕਰਕੇ ਬਠਿੰਡਾ ਬਰਨਾਲਾ ਅਤੇ ਸੰਗਰੂਰ ਵਿੱਚ ਬੋਲੀ ਜਾਂਦੀ ਹੈ ਅਤੇ ਮਾਝੀ ਜਿਹੜੀ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਹੋਰ ਨੇੜਲੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਇਹ ਭਾਸ਼ਾ ਵੀ ਬੋਲਣ ਵਿੱਚ ਬਹੁਤ ਜ਼ਿਆਦਾ ਸੁਖਾਲੀਆਂ ਹਨ ਪਰ ਇਹ ਪੱਛਮੀ ਸੱਭਿਆਚਾਰ ਦੁਆਰਾ ਸਾਡੀਆਂ ਇਹ ਭਾਸ਼ਾ ਲੁਪਤ ਹੁੰਦੀਆਂ ਜਾ ਰਹੀਆਂ ਜਿਹੜੀ ਕਿ ਸਾਨੂੰ ਸੰਭਾਲ ਕੇ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ